ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਸੱਤ ਨਵੰਬਰ ਉੱਨੀ ਸੌ ਚੁਰਾਨਵੇ ਉੱਨੀ ਜਨਵਰੀ ਦੋ ਹਜ਼ਾਰ ਪੰਜ ਅਤੇ ਸੋਲ੍ਹਾਂ ਜੁਲਾਈ ਦੋ ਹਜ਼ਾਰ ਇੱਕੀ